ਸਤਿ ਸ਼੍ਰੀ ਅਕਾਲ ਮੈਂ ਅਰਵਿੰਦ ਭਰਦਵਾਜ ਆਂ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਅਤੇ ਮੈਂ ਤੁਹਾਨੂੰ ਇਹ ਦੱਸਦਾ ਹੈ ਕਿ ਪੰਜਾਬ ਰਾਜ ਵਿੱਚ ਸਾਨੂੰ ਇਹ ਸਮਾਜ ਸੱਭਿਆਚਾਰ ਬਾਰੇ ਕੀ ਪਹਿਰਾਵੇ ਹਨ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਇਹ ਉਹਨਾਂ ਨੂੰ ਜਿਹੜੇ ਹੈਗੇ ਆ ਇਹ ਖੇਤੀਬਾੜੀ ਇਹਨਾਂ ਨੂੰ ਬਹੁਤ ਪਸੰਦ ਹੈਗੀ ਆ ਅਤੇ ਇਹ ਖੇਤੀਬਾੜੀ ਬਹੁਤ ਕਰਦੇ ਹਨ ਅਤੇ ਜਿਹੜਾ ਪਹਿਰਾਵਾ ਹੈ ਪਹਿਰਾਵਾ ਜਿਹੜਾ ਕੁੜਤਾ ਪਜਾਮਾ ਪਾ ਕੇ ਰੱਖਦੇ ਹਨ ਅਤੇ ਇਹਨਾਂ ਦਾ ਜਿਹੜਾ ਸੱਭਿਆਚਾਰ ਆ ਪਹਿਰਾਵੇ ਇਹਦੇ ਪਜਾਮਾ ਕੁੜਤਾ ਸਿੰਪਲ ਰਹਿਗੇ ਸਿੰਪਲ ਬਣ ਕੇ ਰਹਿੰਦੇ ਹਨ ਅਤੇ ਰਹਿਣ ਵਾਲੇ ਇਹਨਾਂ ਦੇ ਜਿਹੜੇ ਮਕਾਨ ਜਿਹੜੇ ਛੋ ਵੱਡੇ ਨਹੀਂ ਹੁੰਦੇ ਇਹ ਛੋਟੇ ਜਿਹੇ ਮਕਾਨ ਹੁੰਦੇ ਮਿੱਟੀ ਦੇ ਬਣੇ ਵੇ ਹੁੰਦੇ ਅਤੇ ਕੁਝ ਮਕਾਨ ਹੁੰਦੇ ਹੈ ਕਿ ਜਿਹਨਾਂ ਦੇ ਕੁਝ ਕੁਝ ਹੀ ਲੋਕ ਹੁੰਦੇ ਹਨ ਜਿਹਨਾਂ ਦੇ ਮਕਾਨ ਵੱਡੇ ਹੁੰਦੇ ਆ ਬਾਕੀ ਲੋਕ ਐਸੇ ਹੁੰਦੇ ਹਨ ਜਿਹਨਾਂ ਦੇ ਮਕਾਨ ਛੋਟੇ ਹੁੰਦੇ ਹਨ ਤਾਂ ਕੇ ਅਸੀਂ ਇਹ ਹੀ ਕੁਝ ਹੈਗਾ ਜੋ ਪੰਜਾਬ ਦਾ ਪਹਿਰਾਵਾ ਅਤੇ ਰਾਜ ਸਮਝਾਵ ਅਤੇ ਮਹਾਂਰਿਸ਼ੀ